ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਅੱਜ ਮੇਰੇ ਬ੍ਰਦਰ ਦਾ ਜਨਮਦਿਨ ਹੈ ਤਾਂ ਮੈਂ ਤੁਹਾਡੇ ਮਤਲਬ ਕੈਫੇ ਤੋਂ ਕੁਛ ਚੀਜ਼ਾਂ ਔਡਰ ਕਰਨੀਆਂ ਆ ਤਾਂ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਂ ਲੰਚ ਦੇ ਲਈ ਸਾਰਾ ਜੋ ਵੀ ਸਮਾਨ ਹੈ ਤੁਸੀਂ ਨੋਟ ਕਰ ਲਿਓ ਜਿਵੇਂ ਕਿ ਕੜਾਹੀ ਪਨੀਰ ਦਾਲ ਮੱਖਣੀ ਬਟਰ ਨਾਨ ਸਨੈਕਸ ਦੇ ਵਿੱਚ ਮਨਚੂਰੀਅਨ ਬਰਗਰ ਸਪਰਿੰਗ ਰੋਲ ਆਦਿ ਤੁਸੀਂ ਸਾਰੀਆਂ ਚੀਜ਼ਾਂ ਟਾਈਮ ਨਾਲ ਘਰ ਭੇਜ ਦਿਓ ਜੀ ਤਾਂ ਕਿ ਲ ਅਸੀਂ ਲੇਟ ਨਾ ਹੋਈਏ ਅਤੇ ਇੱਕ ਗੱਲ ਹੋਰ ਤੁਸੀਂ ਜਦੋਂ ਵੀ ਕੌਫੀ ਭੇਜੋਗੇ ਤਾਂ ਕੌਫੀ ਨੂੰ ਇੱਕ ਚੰਗੇ ਪੈਕਜਿੰਗ ਵਿੱਚ ਭੇਜਿਓ ਤਾਂ ਕਿ ਉਹ ਰਸਤੇ ਵਿੱਚ ਆਉਣ ਟਾਈਮ ਠੰਡੀ ਨਾ ਹੋਵੇ ਧੰਨਵਾਦ